ਸਰਕਾਰੀ ਸਕੀਮਾਂ ਨੇ ਜੀ ਜਿੱਦਾਂ ਆਪਣੀ ਆਟਾ ਦਾਲ ਸਕੀਮ ਹੋ ਗਈ ਬੁਢਾਪਾ ਪੈਨਸ਼ਨ ਹੋ ਗਈ ਅੰਗਹੀਣਾਂ ਦੀ ਪੈਨਸ਼ਨ ਹੋ ਗਈ ਅਲੱਗ ਅਲੱਗ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਨੇਗੀਆਂ ਇਹ ਇੱਕ ਵਧੀਆ ਸਕੀਮ ਹੈਗੀ ਸਰਕਾਰ ਵੱਲੋਂ ਜੋ ਨਹੀਂ ਕੰਮ ਕਰ ਸਕਦੇ ਜਿੱਦਾਂ ਅੰਗਹੀਣ ਹੋ ਗਏ ਬਲਾਇੰਡ ਹੋ ਗਏ ਆਪਣੇ ਡੈਫ ਐਂਡ ਡੰਮ ਹੋ ਗਏ ਜਿਨ੍ਹਾਂ ਨੂੰ ਇਹ ਸਕੀਮ ਦਿੱਤੀ ਜਾਂਦੀ ਹੈਗੀ ਜਿਵੇਂ ਆਟਾ ਦਾਲ ਸਕੀਮ ਹੋ ਗਈ ਇਹ ਜਿਹੜੇ ਹੁਣ ਨਹੀਂ ਕੰਮ ਕਰ ਸਕਦੇ ਉਹਨਾਂ ਦੇ ਘਰਾਂ ਦੇ ਵਿੱਚ ਆਟਾ ਦਾਲ ਸਕੀਮ ਸਕਾ ਚਲਾਈ ਸਰਕਾਰ ਨੇ ਅਤੇ ਇੱਕ ਹੋਰ ਸਕੀਮ ਆ ਜਿਵੇਂ ਹੁਣ ਕਾਲਜਾਂ ਦੇ ਵਿੱਚ ਜਾਂ ਇੰਸਟੀਟਿਊਟ ਦੇ ਵਿੱਚ ਜਾਂ ਆਪਣੇ ਆਈ ਟੀ ਆਈ ਦੇ ਵਿੱਚ ਚੱਲਦੀਆਂ ਨੇਗੀਆਂ ਫਰੀ ਵਾਲੀਆਂ ਸਕੀਮਾਂ ਸਿਲਾਈ ਦੇ ਕੋਰਸ ਹੋ ਗਏ ਜਿੱਦਾਂ ਆਪਣੀ ਕੰਪਿਊਟਰ ਦੇ ਕੋਰਸ ਹੋ ਗਏ ਅਲੱਗ ਅਲੱਗ ਤਰ੍ਹਾਂ ਦੇ ਕੋਰਸ ਹੋ ਗਏ ਜੋ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ ਸਰਕਾਰ ਵੱਲੋਂ ਫਰੀ ਦੇ ਵਿੱਚ ਤਾਂ ਕੀ ਬੱਚੇ ਆਪਣਾ ਅੱਗੇ ਜਾ ਕੇ ਕੋਈ ਕਾਰੋਬਾਰ ਕਰ ਸਕਣ ਆਪਣਾ ਰੋਜੀ ਰੋਟੀ ਕਮਾ ਸਕਣ ਉਹਦੇ ਉਹਦੇ 'ਚ ਜਿਵੇਂ ਅਲੱਗ ਅਲੱਗ ਤਰ੍ਹਾਂ ਦੀਆਂ ਸਕੀਮਾਂ ਪੈਨਸ਼ਨ ਸਕੀਮ ਸਭ ਤੋਂ ਵਧੀਆ ਸਕੀਮ ਹੈਗੀ ਸਰਕਾਰ ਦੀ ਜੋ ਕਿ ਜਿੱਦਾਂ ਵਿਧਵਾ ਹੋ ਗਈ ਵਿਧਵਾ ਨਹੀਂ ਮਤਲਬ ਕਿ ਕਿਸੇ 'ਤੇ ਡਿਪੈਂਡ ਰਹਿ ਸਕਦੀ ਉਹਨੂੰ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈਗੀ ਅਤੇ ਉਹ ਪੈਨਸ਼ਨ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਸਕਦੇ ਨੇਗੇ ਅਠਾਰਾਂ ਸਾਲ ਤੋਂ ਉੱਪਰ ਜਿਹੜੇ ਬੱਚੇ ਹੁੰਦੇ ਨੇ ਜੋ ਵਿਧਵਾ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਵੀ ਪੈਨਸ਼ਨਾਂ ਵਗੈਰਾ ਦਿੱਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਤਾਂ ਕਿ ਆਪਣੇ ਪਰਿਵਾਰ ਵਿੱਚ ਉਹ ਸਹਾਰਾ ਲਗਾ ਸਕਣ ਅਤੇ ਆਪਣੀ ਰੋਜੀ ਰੋਟੀ ਆਪਣੀ ਰੋਟੀ ਚੰਗੀ ਤਰ੍ਹਾਂ ਖਾ ਸਕਣ